ਜਿਵੇਂ ਆਪਾਂ ਕੋਈ ਵੀ ਰੈਸਿਪੀ ਕਰ ਰਹੇ ਹਾਂ ਅਤੇ ਉਹ ਜੇ ਸਾਡੇ ਉਮੀਦ ਅਨੁਸਾਰ ਨਹੀਂ ਹੋ ਰਹੀ ਹੈ ਤਾਂ ਸਾਨੂੰ ਉਹਨੂੰ ਬਰਬਾਦ ਨਹੀਂ ਕਰਨਾ ਚਾਹੀਦਾ ਬਲਕਿ ਉਹਦੇ ਵਿੱਚ ਹੀ ਕੁਝ ਨਾ ਕੁਝ ਆਪਾਂ ਉਹਦੇ ਵਿੱਚ ਚੇਂਜਿਸ ਕਰਕੇ ਉਹਨੂੰ ਵਧੀਆ ਬਣਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਜਿਵੇਂ ਇੱਥੇ ਮੈਂ ਇੱਕ ਉਦਾਹਰਣ ਲੈਂਦਾ ਕਿ ਆਪਾਂ ਆਟਾ ਗੁੱਧ ਰਹੇ ਹਾਂ ਆਟਾ ਗੁੱਧਨ ਦੇ ਨਾਲ ਨਾਲ ਮੈਂ ਆਟਾ ਗੁੱਧ ਰਿਹਾ ਵਾਂ ਅਤੇ ਮੈਂ ਗ਼ਲਤੀ ਨਾਲ ਥੋੜ੍ਹਾ ਪਾਣੀ ਵੱਧ ਪਾਤਾ ਅਤੇ ਮੈਂ ਉਹਨੂੰ ਵੇਸਟ ਨਾ ਕਰਾਂ ਕਿ ਚਲੋ ਪਾਣੀ ਵੱਧ ਪੈ ਗਿਆ ਆਟਾ ਗਿੱਲਾ ਹੋ ਗਿਆ ਮੈਂ ਉਹਨੂੰ ਕੱਢ ਦਾ ਉਹਦੀ ਬਜਾਏ ਮੈਂ ਕੀ ਕਰਾਂ ਥੋੜ੍ਹਾ ਸੁੱਕਾ ਆਟਾ ਉਹਦੇ ਵਿੱਚ ਪਾ ਲਾ ਅਤੇ ਉਹਨੂੰ ਦੁਬਾਰਾ ਗੁੱਧਨਾ ਸ਼ੁਰੂ ਕਰਦਾ ਅਤੇ ਗੁੱਧਦੇ ਗੁੱਧਦੇ ਮਤਲਬ ਉਹ ਵਧੀਆ ਤਰ੍ਹਾਂ ਗੁੰਨਿਆ ਜਾਵੇ ਅਤੇ ਇਹਦੇ ਨਾਲ ਕੀ ਹੋਏਗਾ ਕਿ ਮੈਂ ਵੇਖੋ ਉਸੇ ਦੇ ਵਿੱਚ ਹੀ ਥੋੜ੍ਹੀ ਚੇਂਜਿਸ ਕਰਕੇ ਉਹਨੂੰ ਵਧੀਆ ਤਰ੍ਹਾਂ ਕਰਤਾ ਜਦਕਿ ਜੇਕਰ ਉਹਨੂੰ ਮੈਂ ਦੁਬਾਰਾ ਤੋਂ ਕਰਦਾ ਕੀ ਹਾਂ ਯਾਰ ਆਟਾ ਗਿੱਲਾ ਹੋ ਗਿਆ ਹੁਣ ਉਹਨੂੰ ਛੱਡ ਦਿਉ ਨਵਾਂ ਆਟਾ ਲਉ ਅਤੇ ਇਹਦੇ ਨਾਲ ਸਾਡੇ ਅੰਨ ਦੀ ਤਾਂ ਵੈਸਟੇਜ ਹੁੰਦੀ ਹੁੰਦੀ ਟਾਈਮ ਦੀ ਵੀ ਜਾਂਦੀ ਪੈਸੇ ਦੀ ਬਰਬਾਦੀ ਹੁੰਦੀ ਪਰ ਮੈਂ ਕੀ ਕੀਤਾ ਦਿਮਾਗ਼ ਲਾਇਆ ਕਿ ਨਹੀਂ ਯਾਰ ਆਪਾਂ ਥੋੜ੍ਹਾ ਵ ਵੱਖਰਾ ਆਟਾ ਪਾ ਲੈਂਦੇ ਸੁੱਕਾ ਅਤੇ ਉਹਨੂੰ ਦੁਬਾਰਾ ਗੁੰਨਣੇ ਹਾਂ ਅਤੇ ਉਹ ਚੰਗੀ ਤਰ੍ਹਾਂ ਗੁੰਨਿਆ ਜਾਂਦਾ ਅਤੇ ਉਹ ਨਾਲ ਕੀ ਹੁੰਦਾ ਵਧੀਆ ਆਟਾ ਵੀ ਗੁੰਨਿਆ ਜਾਂਦਾ ਨਾ ਆਪਣਾ ਅੰਨ ਦੀ ਵੈਸਟੇਜ ਹੁੰਦੀ ਨਾ ਪਾਣੀ ਦੀ ਅਤੇ ਨਾ ਸਮੇਂ ਦੀ ਅਤੇ ਇਸ ਤਰ੍ਹਾਂ ਆਪਾਂ ਕੋਈ ਵੀ ਚੀਜ਼ ਜੇਕਰ ਆਪਾਂ ਰੈਸਿਪੀ ਕਰ ਰਹੇ ਹਾਂ ਜੇਕਰ ਉਹ 'ਚ ਤੁਹਾਨੂੰ ਸਾਨੂੰ ਕੁਝ ਲੱਗ ਰਿਹਾ ਕਿ ਖ਼ਰਾਬ ਹੋ ਰਿਹਾ ਵਾ ਤਾਂ ਉਹਨੂੰ ਆਪਾਂ ਬਰਬਾਦ ਨਹੀਂ ਕਰਨਾ ਚਾਹੀਦਾ ਉਹਨੂੰ ਸਾਨੂੰ ਥੋੜ੍ਹੀ ਜੀ ਚੇਂਜਿਸ ਕਰਕੇ ਵਧੀਆ ਕਰ ਲੈਣਾ ਚਾਹੀਦਾ